ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਰ ਸਰ ਮੈਂ ਸਾਹਿਤਪ੍ਰੀਤ ਸਿੰਘ ਦੀ ਮਦਰ ਬੋਲਦੀ ਹਾਂ ਮੇਰਾ ਬੱਚਾ ਸਿਕਸਥ ਕਲਾਸ ਵਿੱਚ ਹੈ ਹਾਂਜੀ ਤੁਸੀਂ ਜਿਵੇਂ ਇੰਚਾਰਜ ਜੇ ਉਸ ਕਲਾਸ ਦੇ ਸੈਕਸ਼ਨ ਏ ਸੈਕਸ਼ਨ ਦੇ ਵਿੱਚ ਹੈ ਸਾਹਿਤਪ੍ਰੀਤ ਸਿੰਘ ਸਰਦਾਰ ਅਰਸ਼ਦੀਪ ਸਿੰਘ ਹਾਂਜੀ ਸਰ ਐਕਚੁਲੀ ਨਾ ਉਹਨੂੰ ਮੈਂ ਆਪਣੇ ਬੇਟੇ ਨੂੰ ਛੁੱਟੀ ਦਵਾਉਣੀ ਸੀ ਇੱਕ ਦੋ ਦਿਨ ਦੀ ਬੜਾ ਅਰਜੈਂਟ ਸੀਗਾ ਨਹੀਂ ਸਰ ਉਹ ਮੈਂ ਤੁਹਾਡੀ ਗੱਲ ਨਾਲ ਹਾਂਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਇਸ ਤਰ੍ਹਾਂ ਇਹ ਕਿ ਸਾਨੂੰ ਆਊਟ ਆਫ ਸਟੇਸ਼ਨ ਜਾਣਾ ਪੈ ਰਿਹਾ ਹੈ ਅਤੇ ਘਰ ਦੇ ਸਾਰੇ ਮਤਲਬ ਕਿ ਸਾਡੇ ਨਾਲ ਹੀ ਜਾ ਰਹੇ ਆ ਅਤੇ ਬੇਟੇ ਦਾ ਫਿਰ ਇਕੱਲਾ ਰਹਿਣਾ ਬੜਾ ਮੁਸ਼ਕਿਲ ਹੈ ਛੋਟਾ ਆ ਕਿਸੇ ਕੋਲ ਅਸੀਂ ਉਹ ਮਤਲਬ ਕਿਸੇ ਕੋਲ ਰਹਿੰਦਾ ਵੀ ਨਹੀਂ ਹੈ ਪਰ ਬੜਾ ਜਰੂਰੀ ਹੈ ਮੈਨੂੰ ਪਤਾ ਹੈ ਕਿ ਛੁੱਟੀ ਨਹੀਂ ਮਿਲਦੀ ਪਰ ਐਮਰਜੈਂਸੀ ਹੈ ਸਰ ਫਸਟ ਹਾਫ ਦੇ ਵਿੱਚ ਪੇਪਰ ਮਤਲਬ ਕਿ ਦਬਾ ਸਕਦੇ ਇਸ ਤਰਾਂ ਸਰ ਪੇਪਰ ਦੀ ਜਿਵੇਂ ਤਿਆਰੀ ਵਗੈਰਾ ਮਤਲਬ ਕਿ ਕਰ ਲਏਗਾ ਤੁਹਾਨੂੰ ਲੱਗਦਾ ਹੈ ਅਤੇ ਅਸੀਂ ਇੱਕ ਦਿਨ ਪਹਿਲਾਂ ਹੀ ਜਾਣਾ ਸੀ ਨਾ ਮਤਲਬ ਇੱਕ ਦਿਨ ਪਹਿਲਾਂ ਜਾਣਾ ਸੀਗਾ ਪੇਪਰ ਵਾਲੇ ਦਿਨ ਨਹੀਂ ਨਾ ਜਾਣਾ ਨਹੀਂ ਪੇਪਰ ਵਾਲੇ ਦਿਨ ਨਹੀਂ ਅਸੀਂ ਜਾ ਆ ਸਕਦੇ ਮਤਲਬ ਕਿ ਅਗਲੇ ਦਿਨ ਹੀ ਸਾਡੇ ਕੋ ਆਇਆ ਜਾਣਾ ਵਾ ਤਾਂ ਹੀ ਤੁਹਾਨੂੰ ਕੋਲ ਕੀਤੀ ਸੀਗੀ ਕਿ ਇਸ ਤਰ੍ਹਾਂ ਪੋਸੀਬਲ ਹੋ ਸਕਦਾ ਹਾਂਜੀ ਅੱਛਾ ਮਤਲਬ ਪੇਪਰ ਲਓਗੇ ਉਹਦੇ ਤਾਂ ਮਤਲਬ ਲੀਵ ਨਹੀਂ ਲੱਗੇਗੀ ਪੇਪਰ ਮਤਲਬ ਕਿ ਲੈਣਾ ਹੀ ਪੈਣਾ ਆ ਕਈ ਵਾਰ ਐਂ ਹੁੰਦਾ ਨਾ ਜਿਵੇਂ ਆਪਣੇ ਸਕੂਲਾਂ ਦੇ ਵਿੱਚ ਆਪਾਂ ਐਵਰੇਜ ਲਾ ਦਿੰਦੇ ਹਾਂ ਉਸ ਤਰ੍ਹਾਂ ਦਾ ਕੁਛ ਨਹੀਂ ਹੋਊਗਾ ਅੱਛਾ ਮੈਂ ਕਿਹਾ ਵਿਆਹ ਵੀ ਜਾਣਾ ਆ ਅਤੇ ਤੁਹਾਨੂੰ ਪਤਾ ਆ ਬੱਚਿਆਂ ਦਾ ਫਿਰ ਅੱਛਾ ਮਤਲਬ ਅਗਲੇ ਦਿਨ ਅਗਲੇ ਦਿਨ ਲਓਗੇ ਜਿਵੇਂ ਉਹਦਾ ਬਾਅਦ 'ਚ ਹੋ ਸਕਦਾ ਅਗਲਾ ਪੇਪਰ ਵੀ ਹੋਵੇ ਕਿ ਇੱਕ ਇੱਕ ਦਿਨ 'ਚ ਦੋ ਪੇਪਰ ਲਓਗੇ ਫਿਰ ਤੁਸੀਂ ਠੀਕ ਹੈ ਜੀ ਠੀਕ ਠੀਕ ਚਲੋ ਠੀਕ ਹੈ ਜੀ ਥੈਂਕ ਯੂ ਸੋ ਮਚ ਸਰ ਓਕੇ ਜੀ ਬਾਏ ਬਾਏ